ਮੇਰੇ ਹਿਸਾਬ ਨਾਲ ਆਧੁਨਿਕ ਬੈਂਕਿੰਗ ਅਤੇ ਬੀਮਾ ਸੇਵਾ ਦੀ ਸੁਰੱਖਿਆ ਅਤੇ ਕੰਮ ਦੇ ਪ੍ਰਬੰਧਨ ਵਿੱਚ ਨਵੀਨ ਤਕਨੀਕਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹੈ ਵਲੋਗ ਚੈਨ ਤਕਨੀਕ ਭੁਗਤਾਨ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਰਕਸ਼ਿਤ ਬਣਾਉਂਦੀ ਹੈ ਜਿਸ ਨਾਲ ਧੋਖੇਧੜੀ ਦੀ ਸੰਭਾਵਨਾ ਘੱਟ ਹੁੰਦੀ ਹੈ ਤੇਜ਼ ਭੁਗਤਾਨ ਪ੍ਰਣਾਲੀ ਜਿਵੇਂ ਕਿ ਯੂ ਪੀ ਆਈ ਨੈਫਟ ਆਰ ਟੀ ਜੀ ਐਸ ਭੁਗਤਾਨ ਦੀ ਗਤੀ ਨੂੰ ਵਧਾਉਂਦੇ ਹਾਂ ਜਿਸ ਨਾਲ ਕਾਰੋਬਾਰ ਤੇਜ਼ੀ ਨਾਲ ਹੋ ਸਕਦਾ ਹੈ ਗਾਹਕ ਸੰਭਾਲ ਸੇਵਾ ਟੂ ਫੋਰ ਸੈਵਨ ਉਪਲੱਬਧ ਹੋਣ ਕਰਕੇ ਗਾਹਕ ਨੂੰ ਆਪਣੀ ਸਮੱਸਿਆ ਨੂੰ ਤੁਰੰਤ ਹੱਲ ਕਰ ਸਕਦੇ ਹਨ ਇਹਨਾਂ ਤਕਨੀਕਾਂ ਦੀ ਵਰਤੋਂ ਬੈਂਗਿੰਗ ਅਤੇ ਜੀਵਨ ਬੀਮਾ ਸੇਵਾ ਨੂੰ ਨਿਰਵਿਘਨ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਬਣਾਉਂਦੀਆਂ ਜਿਸ ਨਾਲ ਆਪਾਂ ਆਪਾਂ ਐਜ਼ ਏ ਕੰਜਿਊਮਰ ਨੂੰ ਵਧੀਆ ਸੇਵਾ ਮਿਲਦੀਆਂ ਹਨ ਆਧੁਨਿਕ ਬੈਂਕਿੰਗ ਅਤੇ ਬੀਮਾ ਸੇਵਾ ਵਿੱਚ ਨਵੀਂ ਤਕਨੀਕ ਦੀ ਵਰਤੋਂ ਕਰਕੇ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਇਸ ਤਰੀਕ ਦੇ ਨਾਲ ਡਾਟਾ ਸੁਰਕਸ਼ਿਤ ਰਹਿੰਦਾ ਹੈ ਧੋਖੇਧਾਰੀ ਨੂੰ ਰੋਕਿਆ ਜਾ ਸਕਦਾ ਹੈ ਆਰਟੀਫਿਸ਼ਅਲ ਇੰਟੈਲੀਜੈਂਸੀ ਅਤੇ ਮਸ਼ੀਨ ਲਾਨਿੰਗ ਦੀ ਮਦਦ ਨਾਲ ਗਹਾਕਾਂ ਨੂੰ ਵੀ ਆਦਤਾਂ ਦਾ ਵਿਸ਼ਲੇਸ਼ਣ ਵੀ ਕੀਤਾ ਜਾਂਦਾ ਜਿਸ ਨਾਲ ਕਿਸੇ ਵੀ ਸ਼ੱਕੀਗਤਵਤੀ ਦੀ ਪਹਿਚਾਣ ਕਰਕੇ ਕਿਸੇ ਵੀ ਗਤੀਵਿਧੀ ਦੀ ਪਹਿਚਾਣ ਕਰਕੇ ਗਾਹਕ ਨੂੰ ਤੁਰੰਤ ਚੇਤਾਵਨੀ ਦਿੱਤੀ ਜਾਂਦੀ ਹੈ ਜਿਵੇਂ ਕਿ ਅੰਗੂਠੇ ਦਾ ਨਿਸ਼ਾਨ ਚਿਹਰੇ ਦੀ ਪਹਿਚਾਣ ਹੋ ਗਈ ਨਾਲ ਖਾਤਿਆਂ ਦੀ ਸੁਰੱਕਸ਼ਾ ਹੋਰ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਡਿਜੀਟਲ ਭੁਗਤਾਨ ਦੇ ਆਉਣ ਦੇ ਨਾਲ ਭੁਗਤਾਨ ਦੀ ਹੋਰ ਗਤੀ ਵੀ ਵੱਧ ਜਾਂਦੀ ਹੈ ਜਿੱਥੇ ਲੋਕ ਘਰ ਬੈਠੇ ਹੀ ਆਸਾਨੀ ਨਾਲ ਲੈਣ ਦੇਣ ਕਰ ਸਕਦੇ ਹਨ ਸਾਈਬਰ ਸੁਰੱਖਿਆ ਨੀਤੀ ਦੇ ਜ਼ਰੀਏ ਗਾਹਕਾਂ ਦੀ ਜਾਣਕਾਰੀ ਵੀ ਰਾਖੀ ਕੀਤੀ ਜਾਂਦੀ ਹੈ ਅਤੇ ਚੌਵੀ ਟੂ ਸੱਤ ਕਸਟਮਰ ਸਪੋਟ ਉਹਨਾਂ ਦੀ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਦੀ ਹੈ ਇਸ ਨਾਲ ਵੀ ਤਕਨੀਕ ਕਾਰਨ ਬੈਂਗਿੰਗ ਅਤੇ ਬੀਮਾ ਸਾਵਾ ਸੇਵਾ ਵੀ ਬਹੁਤ ਜ਼ਿਆਦਾ ਆਸਾਨ ਹੋ ਗਈਆਂ ਅਤੇ ਸੁਰੱਖਿਅਤ ਹੋ ਗਈਆਂ ਜਿਸ ਨਾਲ ਗਾਹਕਾਂ ਦਾ ਵਿਸ਼ਵਾਸ ਬਦਲ ਹੋਰ ਵਧੀਆ ਹੋ ਗਿਆ ਹੈ ਹੁਣ ਆਪਾਂ ਕਿਸੇ ਵੀ ਬਿਨਾਂ ਝਿਜਕਹਾਟ ਤੋਂ ਇਹ ਸੇਵਾ ਸਾਡੀਆਂ ਰੱਖਿਆ ਕਰਨ ਵਿੱਚ ਬਹੁਤ ਹੀ ਜ਼ਿਆਦਾ ਉਪਯੋਗੀ ਹੁੰਦੀਆਂ ਨੇ